ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਮੈਂ ਤਰਨਤਾਰਨ ਦੇ ਵਿੱਚ ਨਵਾਂ ਨਵਾਂ ਆਇਆ ਸੀਗਾ ਅਤੇ ਤੁਸੀਂ ਇੱਥੇ ਦੇ ਓਲਡ ਰੈਜੀਡੈਂਟ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇੱਥੇ ਘੁੰਮਣ ਫਿਰਨ ਨੂੰ ਜਗ੍ਹਾ ਕਿਹੜੀਆਂ ਕਿਹੜੀਆਂ ਹੈਗੀਆਂ ਆ ਮੈਂ ਨਾ ਰੀਸੈਂਟਲੀ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਵਾਂ ਅੱਛਾ ਜੀ ਜਿਵੇਂ ਕਿ ਹਾਂਜੀ ਭਾਅ ਜੀ ਮੈਂ ਵੀ ਸੁਣਿਆ ਸੀ ਕਿ ਦਰਬਾਰ ਸਾਹਿਬ ਇੱਥੇ ਕਾਫ਼ੀ ਪੁਰਾਣਾ ਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਬਣਾਇਆ ਗਿਆ ਇਹ ਗੱਲ ਸੱਚ ਹੈ ਹਾਂਜੀ ਹਾਂਜੀ ਹਾਂਜੀ ਮੈਂ ਗੂਗਲ 'ਤੇ ਵੀ ਦੇਖ ਰਿਹਾ ਸੀਗਾ ਮੈਂ ਕਿਹਾ ਇਹ ਦਰਬਾਰ ਸਾਹਿਬ ਦਾ ਸਰੋਵਰ ਬਹੁਤ ਵੱਡਾ ਆ ਅੱਛਾ ਜੀ ਉਹ ਕਦੋਂ ਆ ਰਿਹਾ ਕੋਈ ਡੇਟ ਅੱਛਾ ਜੀ ਦੋ ਫੈੱਬ ਨੂੰ ਆ ਰਿਹਾ ਅਤੇ ਉੱਥੋਂ ਸੰਗਤ ਆਉਂਦੀ ਕਿਤੋਂ ਬਾਹਰੋਂ ਸ਼ਹਿਰਾਂ ਤੋਂ ਵੀ ਠੀਕ ਹੈ ਜੀ ਅਤੇ ਭਾਅ ਜੀ ਇੱਥੇ ਇੱਕ ਗੋਇੰਦਵਾਲ ਸਾਹਿਬ ਕਰਕੇ ਜਗ੍ਹਾ ਹੈਗੀ ਆ ਉਹ ਕਿੱਥੇ ਪੈਂਦੀ ਜੀ ਆਪਣੀ ਕਿੱਥੇ ਕਿੱਧਰ ਕੁ ਪੈਂਦੀ ਆ ਅਤੇ ਬੱਸ ਜਾਂਦੀ ਭਲਾ ਉੱਥੇ ਅਤੇ ਭਾਅ ਜੀ ਬੱਸਾਂ ਬੁੱਸਾਂ ਇੱਥੇ ਵਧੀਆ ਮਤਲਬ ਟਰੈਵਲ ਕਰਨਾ ਹੋਵੇ ਤਾਂ ਬੱਸਾਂ ਦਾ ਸਫ਼ਰ ਵਧੀਆ ਰਹਿੰਦਾ ਆ ਅੱਛਾ ਆਟੋ ਮਿਲ ਜਾਂਦੇ ਆ ਅੱਛਾ ਜੀ ਅੱਛਾ ਖਾਣ ਪੀਣ ਨੂੰ ਮਤਲਬ ਵਧੀਆ ਜਗ੍ਹਾ ਹੈਗੀਆਂ ਚਲੋ ਠੀਕ ਹੈ ਭਾਅ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ